ਪੰਜਾਬ ਵਿੱਚ ਕਈ ਤਰ੍ਹਾਂ ਦੇ ਧਰਮ ਹਨ ਜਿੱਦਾਂ ਕਿ ਸਿੱਖ ਧਰਮ ਹਿੰਦੂ ਧਰਮ ਜਾਂ ਅੱਜ ਕੱਲ੍ਹ ਕ੍ਰਿਸ਼ਚਨ ਧਰਮ ਕਾਫੀ ਪੰਜਾਬ 'ਚ ਫੈਲ ਰਿਹਾ ਤੇਜ਼ੀ ਨਾਲ ਅਤੇ ਉਸ ਤੋਂ ਬਾਅਦ ਆਉਂਦਾ ਮੁਸਲਿਮ ਧਰਮ ਜੈਨ ਅਤੇ ਬੋਧ ਅਤੇ ਹਰ ਧਰਮ ਆਪਣੇ ਅਕੋਰਡਿੰਗ ਆਪਣੀਆਂ ਆਪਣੇ ਧਰਮ ਨੂੰ ਜਿੱਦਾਂ ਜਿੱਦਾਂ ਧਰਮ ਦੀ ਪਾਲਣਾ ਕਰਦਾ ਅਤੇ ਰਸਮਾਂ ਦੀ ਪਾਲਣਾ ਕਰਦਾ ਜਿੱਦਾਂ ਕਿ ਜਿੱਦਾਂ ਕਿ ਆਪਣੇ ਸਿੱਖ ਲੋਕ ਹੈਗੇ ਆ ਜਾਂ ਹਿੰਦੂ ਲੋਕ ਹੈਗੇ ਨੇ ਉਹ ਭੇਟਾ ਦਿੰਦੇ ਨੇ ਠੀਕ ਹੈ ਜੀ ਅਤੇ ਉਸ ਤੋਂ ਬਾਅਦ ਜਿੱਦਾਂ ਆਪਣੇ ਸਿੱਖ ਜਾਂ ਹਿੰਦੂ ਯਾਤਰਾਵਾਂ 'ਤੇ ਜਾਂਦੇ ਨੇ ਜਿੱਦਾਂ ਕਿ ਆਪਣੇ ਅੱਜ ਕੱਲ੍ਹ ਸਿੱਖ ਲੋਕ ਜਾ ਰਹੇ ਮਨੀਕਰਨ ਸਾਹਿਬ ਦੀ ਯਾਤਰਾ 'ਤੇ ਜਾ ਰਹੇ ਨੇ ਜਾਂ ਇੱਧਰ ਆਪਣਾ ਹੇਮਕੁੰਟ ਸਾਹਿਬ ਦੀ ਯਾਤਰਾ ਖੁੱਲ੍ਹ ਗਈ ਹੈ ਅਤੇ ਉੱਧਰ ਜਾ ਰਹੇ ਨੇ ਹਿੰਦੂ ਲੋਕ ਜਿਹੜੇ ਨੇ ਉਹ ਵੀ ਯਾਤਰਾ ਵੱਲ ਪਹੁੰਚ ਜਾਂਦੇ ਨੇ ਜਿੱਦਾਂ ਕਿ ਆਪਣਾ ਇੱਧਰ ਹਿਮਾਚਲ 'ਚ ਕਾਫੀ ਆਪਣੇ ਚਿੰਤਪੁਰਨੀ ਮਾਤਾ ਚਿੰਤਪੁਰਨੀ ਜਵਾਲਾ ਜੀ ਕਾਂਗੜਾ ਮਹਾਬਲੇਸ਼ਵਰ ਜਾਂ ਫਿਰ ਕੈਦਾਰਨਾਥ ਬਦਰੀਨਾਥ ਅਮਰਨਾਥ ਦੀ ਯਾਤਰਾ 'ਤੇ ਜਾਂਦੇ ਨੇ ਅਤੇ ਉਸ ਤੋਂ ਬਾਅਦ ਹਿੰਦੂ ਲੋਕ ਜਿਹੜੇ ਜਾਂਦੇ ਨੇ ਉਹ ਜਾਂਦੇ ਨੇ ਆਪਣਾ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਅਤੇ ਜਿਹੜੇ ਕ੍ਰਿਸਚਨ ਲੋਕ ਨੇ ਉਹ ਆਪਣੀਆਂ ਪ ਪ੍ਰਾਰਥਨਾਵਾਂ ਕਰਦੇ ਆ ਜਿੱਦਾਂ ਕਿ ਸੰਡੇ ਪ੍ਰਾਰਥਨਾ 'ਤੇ ਜਾਂਦੇ ਨੇ ਹਰ ਕੋਈ ਚਰਚ ਜਾਂਦੇ ਨੇ ਉੱਥੇ ਪ੍ਰਾਰਥਨਾਵਾਂ ਕਰਦੇ ਨੇ ਠੀਕ ਹੈ ਜੀ ਅਤੇ ਇਸ ਤੋਂ ਇਲਾਵਾ ਜਿਹੜੇ ਮੁਸਲਿਮ ਲੋਕ ਨੇ ਉਹ ਆਪਣਾ ਜਿੱਦਾਂ ਹਰ ਸ਼ੁੱਕਰਵਾਰ ਸ਼ੁੱਕਰਵਾਰ ਆਪਣੀ ਉੱਥੇ ਜਾ ਕੇ ਮਸਜਿਦ 'ਚ ਜਾ ਕੇ ਆਪਣੀ ਉਹ ਨਮਾਜ਼ ਪੜ੍ਹਦੇ ਨੇ ਅਤੇ ਬਾਕੀ ਪੰਜਾਬ ਵਿੱਚ ਜਿਹੜਾ ਪ੍ਰਮੁੱਖ ਹੈਗਾ ਵਿਆ ਧਾਰਮਿਕ ਜਿਹੜੇ ਚਲਦੇ ਨੇ ਉਹ ਚਲਦੇ ਨੇ ਯਾਤਰਾਵਾਂ 'ਤੇ ਜਾਣਾ ਤੀਰਥ ਯਾਤਰਾ ਕਰਨੀ ਅਤੇ ਜਾਂ ਫਿਰ ਭੇਟਾਂ ਭੇਟਾਂ ਦੇਣੀਆਂ ਅਤੇ ਇਹਨਾਂ ਨੂੰ ਫੋਲੋ ਕਰਦੇ ਨੇ ਕਿਉਂਕਿ ਪੰਜਾਬੀ ਲੋਕ ਯਾਤਰਾ ਜ਼ਿਆਦਾ ਕਰਦੇ ਨੇ ਅਤੇ ਇੱਥੇ ਆਏ ਦਿਨ ਕੋਈ ਨਾ ਕੋਈ ਮੇਲੇ ਲੱਗੇ ਰਹਿੰਦੇ ਨੇ ਅਤੇ ਆਪਣੇ ਪੰਜਾਬੀ ਉਹਨਾਂ ਜਗ੍ਹਾਵਾਂ 'ਤੇ ਜਾ ਕੇ ਯਾਤਰਾ ਕਰਕੇ ਜਾਂਦੇ ਨੇ ਅਤੇ ਉੱਥੇ ਜਾ ਕੇ ਮੱਥਾ ਵਗੈਰਾ ਟੇਕਦੇ ਨੇ